ਸਤਿ ਸ੍ਰੀ ਅਕਾਲ ਜੀ ਮੈਂ ਵੈਸ਼ਨੋ ਦੇਵੀ ਮਾਤਾ ਦੇ ਯਾਤਰਾ ਦੇ ਗਿਆ ਸੀ ਯਾਰਾਂ ਦੋਸਤਾਂ ਦੇ ਨਾਲ ਕੁਛ ਚਿਰ ਪਹਿਲੇ ਮੈਂ ਅਸੀਂ ਯਾਰਾਂ ਦੋਸਤਾਂ ਦੇ ਨਾਲ ਪਹੁੰਚੇ ਅਸੀਂ ਮੱ ਵੈਸ਼ਨੋ ਦੇਵੀ ਦੇ ਮੱਥਾ ਟੇਕਣ ਲੱਗੇ ਮੱਥਾ ਟੇਕ ਕੇ ਅਸੀਂ ਬਾਹਰ ਆਏ ਮੈਂ ਯਾਰਾਂ ਦੋਸਤਾਂ ਦੇ ਨਾਲ ਖਾਣਾ ਖਾਉਣ ਲੱਗਾ ਮੈਂ ਖਾਣਾ ਖਾ ਕੇ ਮੈਂ ਆਪਣੇ ਬੂਟ ਪਹਿਨਣ ਲੱਗਾ ਮੇਰੇ ਯਾਰ ਦੋਸਤ ਮੇਰੇ ਨਾਲੋਂ ਵਿਛੜ ਗਏ ਸੀ ਇਸ ਕਰਕੇ ਮੈਂ ਉਹਨਾਂ ਤੋਂ ਪਿੱਛੇ ਰਹਿ ਗਿਆ ਸੀ ਮੈਂ ਕੁਝ ਚਿਰ ਪਹਿਲਾਂ ਇੱਧਰ ਉੱਧਰ ਦੇਖਿਆ ਮੈਨੂੰ ਕੋਈ ਆਪਣਾ ਯਾਰ ਦੋਸਤ ਨਹੀਂ ਮਿਲਿਆ ਇਸ ਕਰਕੇ ਮੇਰੇ ਕੋਲੋਂ ਮੋਬਾਈਲ ਮੇਰੇ ਕੋਲ ਮੋਬਾਇਲ ਸੀ ਨਾ ਉਹਨਾਂ ਤਾਂ ਮੋਬਾਇਲ ਨਾਲ ਇਸਤੇਮਾਲ ਕੀਤਾ ਇਸ ਕਰਕੇ ਮੈਨੂੰ ਥੋੜ੍ਹਾ ਜਿੰਨਾ ਘਰ ਪਹੁੰਚਣ ਦੀ ਬਹੁਤ ਤਕਲੀਫ ਸੀ ਇਸ ਕਰਕੇ ਮੈਂ ਉਹਨਾਂ ਦੇ ਫੋਨ 'ਤੇ ਕੰਟੈਕਟ ਕੀਤਾ ਮੈਨੂੰ ਘਰ ਪਹੁੰਚਣ ਦਾ ਇਸਤੇਮਾਲ ਹੋ ਗਿਆ ਸੀ ਸਤਿ ਸ੍ਰੀ ਅਕਾਲ